ਉਹ ਦਿਨ ਮੈਨੂੰ ਅਜੇ ਵੀ ਯਾਦ ਹੈ ਜਿਸ ਦਿਨ ਮੇਰੇ ਪਿਤਾ ਜੀ ਨੇ ਮੈਨੂੰ ਸਟਾਰਗੇਜਿੰਗ ਵਾਲੀ ਕਿਤਾਬ ਲਿਆ ਕੇ ਦਿੱਤੀ ਸੀ ਉਸ ਨਾਲ ਹੀ ਮੇਰਾ ਸਟਾਰਗੇਜਿੰਗ ਪ੍ਰਤੀ ਬਹੁਤ ਜ਼ਿਆਦਾ ਰੁਝਾਉ ਵੱਧ ਗਿਆ ਮੈਂ ਸਟਾਰਗੇਜਿੰਗ ਬਾਰੇ ਬਹੁਤ ਕੁਝ ਪੜ੍ਹਿਆ ਅਤੇ ਉਸ ਬਾਰੇ ਸਟਾਰ ਬਾਰੇ ਜਾਣਨ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਮੈਨੂੰ ਯਾਦ ਹੈ ਕਿ ਸਟਾਰਗੇਜਿੰਗ ਇੱਕ ਅਜਿਹੀ ਕਿਤਾਬ ਸੀ ਜਿਸ ਨੇ ਮੇਰੀ ਜ਼ਿੰਦਗੀ ਵਿੱਚ ਪਰਿਵਰਤਨ ਕਰ ਦਿੱਤਾ ਹਾਲਾਂਕਿ ਸਿਤਾਰਿਆਂ ਬਾਰੇ ਸਟੱਡੀ ਕਰਨਾ ਥੋੜ੍ਹਾ ਮੁਸ਼ਕਲ ਹੈ ਅਤੇ ਥੋੜ੍ਹੇ ਜਿਹਾ ਰੁਚੀ ਵਾਲਾ ਕੰਮ ਵੀ ਹੈ ਲੇਕਿਨ ਪਰ ਮੈਨੂੰ ਸਟਾਰ ਬਹੁਤ ਕੁਛ ਵਧੀਆ ਲੱਗਦੇ ਹਨ ਅਤੇ ਉਹਨਾਂ ਵਿੱਚੋਂ ਇੱਕ ਨੈਪਚੁਨ ਨੈਪਚੁਨ ਗ੍ਰਹਿ ਜਿਸਨੂੰ ਸਭ ਤੋਂ ਵੱਧ ਚਮਕਣ ਵਾਲਾ ਤਾਰਾ ਵੀ ਮੰਨਿਆ ਜਾਂਦਾ ਹੈ ਜਿਸ ਵਿੱਚ ਰੈਡ ਪਲੈਨਟ ਵੀ ਹੈ ਅਤੇ ਉਹ ਸਭ ਤੋਂ ਵੱਧ ਚਮਕਦਾ ਹੈ ਤਾਰਿਆਂ ਵਿੱਚ ਅਤੇ ਉਸ ਤੋਂ ਬਾਅਦ ਮੇਰੇ ਪਿਤਾ ਜੀ ਨੇ ਮੈਨੂੰ ਸਟੈਲੀਸਕੋਪ ਲਿਆ ਕੇ ਦਿੱਤਾ ਜਿਸ ਨਾਲ ਮੈਨੂੰ ਵਾਰ ਵਾਰ ਉੱਪਰ ਤਾਰਿਆਂ ਨੂੰ ਵੱਲ ਦੇਖਣਾ ਬਹੁਤ ਵਧੀਆ ਲੱਗਦਾ ਸੀ ਜਦੋਂ ਵੀ ਮੈਂ ਰਾਤ ਨੂੰ ਸੌਂਦਾ ਸੀ ਤਾਂ ਤਾਰਿਆਂ ਤਾਰਿਆਂ ਵੱਲ ਦੇਖਦਾ ਅਤੇ ਮੈਨੂੰ ਇੰਝ ਲੱਗਦਾ ਕਿ ਜੇ ਮੈਂ ਕਾਸ਼ ਮੈਂ ਜਾਂਦਾ ਕਿ ਤਾਰਾ ਤਾਰੇ ਉੱਪਰ ਜਾ ਤਾਰੇ ਵੱਲ ਜਾਂਦਾ ਅਤੇ ਉਹਨਾਂ ਨੂੰ ਤੱਕਦਾ ਅਤੇ ਉਹਨਾਂ ਵੱਲ ਹੱਥ ਲਗਾ ਕੇ ਦੇਖਦਾ ਕਿ ਤਾਰੇ ਕਿਹੋ ਜਿਹੇ ਹੁੰਦੇ ਇਸ ਲਈ ਮੈਨੂੰ ਤਾਰੇ ਦੇਖਣਾ ਬਹੁਤ ਵਧੀਆ ਪਸੰਦ ਲੱਗਦਾ ਹੈ ਤਾਰਿਆਂ ਨੂੰ ਦੇਖਦੇ ਘੰਟਾ ਹੀ ਬੀਤ ਜਾਂਦਾ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਤਾਰਿਆਂ ਵੱਲ ਕੀ ਕੁਝ ਦੇਖਦਾ ਬਹੁਤ ਦੁਨੀਆ ਵਿੱਚ ਬਹੁਤ ਸਾਰੇ ਤਾਰੇ ਹਨ ਅਤੇ ਤਾਰਿਆਂ ਬਾਰੇ ਮੇਰੇ ਦੋਸਤ ਨੇ ਇੱਕ ਗ ਗੱਲ ਵੀ ਦੱਸੀ ਹੈ ਕਿ ਤਾਰੇ ਇੱਕ ਪਾਸਟ ਪਾਸਟ ਵਿੱਚ ਰਹਿੰਦੇ ਹਨ ਸਾਨੂੰ ਉਹ ਬੁਝੇ ਹੁੰਦੇ ਹਨ ਪਰ ਸਾਨੂੰ ਫਿਰ ਵੀ ਟਿਮ ਟਿਮਾਉਂਦੇ ਨਜ਼ਰ ਆਉਂਦੇ ਹਨ ਇਸ ਲਈ ਮੈਨੂੰ ਤਾਰੇ ਬਹੁਤ ਵਧੀਆ ਲੱਗਦੇ ਹਨ